ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਮੇਰਾ ਨਾਮ ਪਿੰਕੀ ਹੈ ਮੈਂ ਇਸਲਾਮਾਬਾਦ ਮੁਹੱਲਾ ਤੋਂ ਬੋਲਦੀ ਪਈ ਐਂ ਹਾਂਜੀ ਹਾਂਜੀ ਤੁਹਾ ਤੁਹਾਡੇ ਇੱਧਰ ਦੁਕਾਨ ਹੈਗੀ ਕੋਈ ਵਧੀਆ ਥੋਕ ਦੀ ਹਾਂਜੀ ਹਾਂਜੀ ਹਾਂਜੀ ਮੈਂ ਵੀ ਦੁਕਾਨ ਖੋਲ੍ਹੀ ਹੈ ਨਾ ਅਤੇ ਮੈਨੂੰ ਵੀ ਸਮਾਨ ਹਾਂਜੀ ਮੈਂ ਵੀ ਸਮਾਨ ਸਮੂਨ ਲੈਣ ਆਉਣਾ ਵਾ ਤੁਹਾਨੂੰ ਪੁੱਛਦੀ ਪਈ ਕਿ ਇੱਥੇ ਵਧੀਆ ਸਮਾਨ ਮਿਲਦਾ ਹੈ ਹਾਂਜੀ ਚਲੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਅਸੀਂ ਆ ਕੇ ਪਤਾ ਕਰ ਲਾਂਗੇ ਠੀਕ ਹੈ ਸਮਾਨ ਬਾਰੇ ਕਿ ਕੀ ਭਾਅ ਦਿੰਦੇ ਹੈ ਹਾਂਜੀ ਚਲੋ ਹਾਂਜੀ ਅਸੀਂ ਤਾਂ ਲਾਗੇ ਸਾਨੂੰ ਹੋਰ ਕੋਈ ਦੁਕਾਨ 'ਤੇ ਜਾਂਦੇ ਹਾਂ ਅਤੇ ਉਥੋਂ ਥੋੜ੍ਹਾ ਸਮਾਨ ਮਹਿੰਗਾ ਮਿਲਦਾ ਸਾਨੂੰ ਅਤੇ ਤੁਹਾਡੇ ਚਲੋ ਅਸੀਂ ਆ ਕੇ ਦੁਕਾਨ 'ਤੇ ਪਤਾ ਕਰ ਲਾਂਗੇ ਕਿ ਕੀ ਭਾਅ ਮਤਲਬ ਕੀ ਦਿੰਦੇ ਹੋ ਤੁਸੀਂ ਸੌਦਾ ਸੁਦਾ ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਚਲੋ ਕੋਈ ਨਹੀਂ ਅਸੀਂ ਆ ਕੇ ਫੇਰ ਪਤਾ ਕਰ ਲਾਂਗੇ ਅਤੇ ਫੇਰ ਅਸੀਂ ਸਮਾਨ ਲੈ ਜਾਂਗੇ ਹਾਂਜੀ ਠੀਕ ਹੈ ਸ ਸਤਿ ਸ਼੍ਰੀ ਅਕਾਲ ਜੀ